ਹਾਂਜੀ ਵਧੀਆ ਵਧੀਆ ਜੀ ਤੁਸੀਂ ਦੱਸੋ ਅੱਛਾ ਅੱਛਾ ਜੀ ਅੱਛਾ ਅੱਛਾ ਜੀ ਬੱਚੇ ਤਾਂ ਇਹ ਸੀ ਬੀ ਐੱਸ ਈ ਬੋਰਡ 'ਚ ਹੀ ਵਧੀਆ ਹੈ ਨਾ ਜਿੱਥੇ ਕਿ ਐਕਟੀਵਿਟੀਜ ਵੀ ਕਾਫ਼ੀ ਹੋਣ ਜਿੱਦਾਂ ਸਵਿਮਿੰਗ ਹੋ ਗਈ ਅਤੇ ਉਹ ਭਵਾਂ ਡਾਂਸਿੰਗ ਹੋ ਗਈ ਗੇਮਸ ਹੋ ਗਈਆਂ ਹੈ ਨਾ ਤੁਹਾਡੇ ਇੱਧਰ ਕੁਛ ਵੀ ਨਹੀਂ ਹੈਗਾ ਕੋਈ ਐਕਟੀਵਿਟੀ ਨਹੀਂ ਕਰਵਾ ਰਹੇ ਅੱਛਾ ਅੱਛਾ ਜੀ ਨਹੀਂ ਇੱਧਰ ਤਾਂ ਕਾਫ਼ੀ ਸਕੂਲ ਜੇਧਰ ਹੈਗੇ ਆ ਆਪਣੇ ਉੱਧਰ ਕਾਫ਼ੀ ਸਕੂਲ ਵਧੀਆ ਵਧੀਆ ਹੈਗੇ ਆ ਫੋਰ ਐਕਜਾਂਪਲ ਦੂਨ ਦੂਨ ਸਕੂਲ ਵੀ ਵਧੀਆ ਲਿਟਲ ਫਲਾਰ ਵੀ ਵਧੀਆ ਬਚਪਨ ਸਕੂਲ ਵੀ ਵਧੀਆ ਕਿਡਜ਼ ਇੰਟਰਨੈਸ਼ਨਲ ਸਾਰੇ ਵਧੀਆ ਸਕੂਲ ਇਹਨਾਂ ਵਿੱਚ ਕਾਫ਼ੀ ਐਕਟੀਵਿਟੀਜ਼ ਹੈਗੀਆ ਹਾਂਜੀ ਹਾਂ ਗੇਮਜ਼ ਵਗੈਰਾ ਕਾਫ਼ੀ ਹੈਗੀਆਂ ਇਹਨਾਂ ਵਿੱਚ ਸਵਿਮਿੰਗ ਵੀ ਹੈਗੀ ਹਾਂਜੀ ਹਾਂ ਨਹੀਂ ਇਹਨਾਂ ਵਿੱਚੋਂ ਕੁਛ ਜਿਹੜੇ ਆ ਆਈ ਸੀ ਆਈ ਸੀ ਬੋਰਡ ਹੈ ਬਾਕੀ ਜਿਹੜੇ ਆ ਉਹ ਸੀ ਬੀ ਐੱਸ ਈ ਬੋਰਡ ਹੈ ਅਤੇ ਸੀ ਬੀ ਐੱਸ ਈ ਵੀ ਵਧੀਆ ਹੈ ਅਤੇ ਆਈ ਸੀ ਐੱਸ ਸੀ ਵੀ ਵਧੀਆ ਹੈ ਚਲੋ ਪੰਜਾਬ ਬੋਰਡ ਵੀ ਚਲੋ ਸੀ ਬੀ ਐੱਸ ਈ ਥੋੜ੍ਹਾ ਜ਼ਿਆਦਾ ਵਧੀਆ ਹੋ ਜਾਂਦਾ ਹੈ ਹਾਂਜੀ ਹਾਂ ਫੀਸ ਜੇ ਤਾਂ ਤੁਹਾਡੇ ਦੋ ਬੱਚੇ ਆ ਫਿਰ ਤਾਂ ਥੋੜ੍ਹਾ ਲੈਸ ਕਰ ਦਿੰਦੇ ਆ ਅਤੇ ਅਦਰਵਾਈਜ਼ ਫੀਸ ਠੀਕ ਹੈ ਬਹੁਤ ਜ਼ਿਆਦਾ ਵੀ ਨਹੀਂ ਹੈਗੀ ਔਰ ਬਹੁਤ ਘੱਟ ਵੀ ਨਹੀਂ ਹੈਗੀ ਹਾਂਜੀ ਹਾਂ ਨਾਲੇ ਸ਼ਹਿਰ ਦੇ ਵਿੱਚ ਵਿੱਚ ਪੈਂਦੇ ਆ ਬੱਸ ਸਰਵਿਸ ਅਵੇਲੇਬਲ ਹੈ ਅਤੇ ਹਾਂਜੀ ਹਾਂਜੀ ਹਾਂਜੀ ਹਾਂਜੀ ਓਕੇ ਥੈਂਕ ਯੂ